ਸਭ ਤੋਂ ਪਹਿਲਾਂ ਮੇਰੀ ਮਨਪਸੰਦ ਥਾਵਾਂ 'ਚੋਂ ਇੱਕ ਜੋ ਕਿ ਮੇਰੇ ਸਿੱਖ ਧਰਮ ਨਾਲ ਸੰਬੰਧ ਹੈ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਉੱਥੇ ਜਾਂਦੇ ਰਹਿੰਦੇ ਅਸੀਂ ਇਸ ਤੋਂ ਬਿਨਾ ਫੌਜ ਦੇ ਵਿੱਚ ਰਹਿੰਦਿਆਂ ਹੋਇਆਂ ਦੇਹਰਾਦੂਨ ਮਸੂਰੀ ਦੇ ਵਿੱਚ ਜਾਣਾ ਬਹੁਤ ਜ਼ਿਆਦਾ ਪਸੰਦ ਸੀ ਉੱਥੇ ਬਹੁਤ ਹੀ ਟੂਰਿਸ਼ਟ ਪਲੇਸ ਸੀ ਇਸ ਕਰਕੇ ਜਾਂਦੇ ਸੀ ਔਰ ਉੱਥੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਸੀ ਕਿਉਂਕਿ ਉੱਥੇ ਸੀ ਆਰ ਪੀ ਐੱਫ ਦਾ ਟਰੇਨਿੰਗ ਕੈਂਪ ਹੁੰਦਾ ਸੀ ਟਰੇਨਿੰਗ ਵਾਸਤੇ ਜਾਂਦੇ ਸੀ ਇਸ ਤੋਂ ਬਿਨਾ ਸ਼ਿਕੰਦਰਾਬਾਦ ਦੇ ਵਿੱਚ ਬਹੁਤ ਹੀ ਐਜੂਕੇਟਿਡ ਸਿਟੀ ਹੈ ਬਹੁਤ ਕੁਛ ਸਿੱਖਣ ਨੂੰ ਮਿਲਦਾ ਸੀ ਬੜੇ ਬੜੇ ਹੋਸਟਲਾਂ ਦੇ ਵਿੱਚ ਘੁੰਮਣ ਦਾ ਮੌਕਾ ਮਿਲਿਆ ਬਹੁਤ ਕੁਛ ਸਿੱਖਿਆ ਔਰ ਇਸ ਪ੍ਰਕਾਰ ਲਾਸਟ ਪਲੇਸ ਸ਼ਾਹਜਹਾਨਪੁਰ ਦੇ ਵਿੱਚ ਵੀ ਸਿੱਖਣ ਨੂੰ ਬਹੁਤ ਕੁਛ ਮਿਲਿਆ